ਦੀਆ ਤੁਸੀਂ ਕਦੇ ਆਰਟ ਦਾ ਕੰਮ ਕੀਤਾ ਹੈ ਕੁਛ ਬਣਾਇਆ ਤੁਸੀਂ ਆਰਟ ਦੇ ਵਿੱਚ ਮੈਂ ਆਰਟ ਵਿੱਚ ਬਹੁਤ ਕੁਛ ਬਣਾਇਆ ਹੈ ਮੈਂ ਚਣੇ ਦੀ ਦਾਲ ਨਾਲ ਗਣਪਤੀ ਜੀ ਬਣਾਏ ਹੈ ਮੋਮਬੱਤੀਆਂ ਬਣਾਈਆਂ ਹੈ ਬੇ ਮਾਲਾ ਬਣਾਈਆਂ ਹਨ ਅਤੇ ਪੱਖੀਆਂ ਵੀ ਬੁਣੀਆਂ ਹਨ ਕਾਫੀ ਕੁਛ ਬਣਾਇਆ ਹੈ ਵੇਸਟ ਨਿਊ ਨਿਊਜ਼ਪੇਪਰ ਦੇ ਪੀਕੋਕ ਵੀ ਬਣਾਏ ਹੈ